ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਬਾਕੀ ਸਾਰੇ ਪਿੰਡਾਂ ਚ ਤਾਂ ਪਰਾਲੀ ਮਚਾਣੀ ਅਸੀਂ ਬੰਦ ਕਰਵਾ ਦਿੱਤੀ ਸੀ ਤਾਂ ਤੁਹਾਡੇ ਪਿੰਡ ਪਿੰਡ 'ਚ ਹਜੇ ਵੀ ਚੱਲੀ ਜਾਂਦੀ ਹੈ ਪਰਾਲੀ ਸਾੜਨੀ ਅੱਛਾ ਤੁਹਾਡੇ ਪਿੰਡ 'ਚ ਠੀਕ ਹੈ ਅਤੇ ਉਹ ਕੀ ਕਹਿੰਦੇ ਨੇ ਤੁਸੀਂ ਆਏਂ ਕਰੋ ਸਾਰੀ ਯੂਥ ਆਪਣੇ ਨਾਲ ਦੇ ਲੜਕੇ ਹੈ ਜਿਹੜੇ ਉਨ੍ਹਾਂ ਨੂੰ ਇਕੱਠਾ ਕਰੋ ਤੁਸੀਂ ਕੀ ਮਤਲਬ ਤੁਸੀਂ ਮੈਨੂੰ ਕੋਈ ਸੁਜੇਸ਼ਨ ਦੱਸੋ ਕੀ ਕਰ ਸਕਦੇ ਹੈ ਤੁਸੀਂ ਪਰਾਲੀ ਨੂੰ ਰੋਕਣ ਵਾਸਤੇ ਵੈਸੇ ਮੈਂ ਤਾਂ ਕਹਿੰਦਾ ਹੈਗਾ ਕਿ ਹਾਂ ਮੈਂ ਕਹਿੰਦੀ ਹਾਂ ਵੀ ਹਾਂ ਹਾਂ ਰੈਲੀਆਂ ਵੀ ਤੁਸੀਂ ਕੱਢ ਸਕਦੇ ਹੋ ਇਹਦੇ ਲਈ ਜ਼ਿਆਦਾ ਬੈਟਰ ਤਾਂ ਰੈ ਰੈਲੀਆਂ ਹੀ ਰਹਿਣਗੀਆਂ ਮੈਨੂੰ ਲੱਗਦਾ ਹੈ ਹਾਂਜੀ ਹਾਂਜੀ

ਹਾਂਜੀ ਹਾਂਜੀ ਕੋਈ ਨਾ ਮੈਂ ਇੱਕ ਵਾਰ ਪਿੰਡ 'ਚ ਆ ਕੇ ਦੌਰਾ ਕਰਕੇ ਜਾਊਂਗਾ ਅਤੇ ਬਾਕੀ ਦੇਖ ਕੇ ਜਾਊਂਗਾ ਕਿ ਇਹ ਕਿਵੇਂ ਮਤਲਬ ਤੁਹਾਡੇ ਇਹ ਰੌਲਾ ਹੈਗਾ ਜਾਂ ਪਰਾਲੀ ਨੂੰ ਲੋਕ ਕਿਵੇਂ ਕੀ ਕਹਿੰਦੇ ਹੈ ਇੱਕ ਵਾਰ ਦੇਖਦੇ ਹੈ ਆਪਾਂ ਮੀਟਿੰਗ ਕਰਕੇ ਪੰਚਾਇਤ ਸ ਸ ਇੱਕਠੇ ਹਾਂ ਹਾਂ ਇਹ ਗੱਲ ਤਾਂ ਤੁਹਾਡੀ ਸਹੀ ਹੈ ਇਹ ਤੁਹਾਡੇ ਹਾਂ ਹਾਂ ਤੁਸੀਂ ਬੇਫ਼ਿਕਰ ਰਹੋ ਮੈਂ ਗੱਲ ਬਾਤ ਕਰਦਾ ਨਾਲ ਦੇ ਮੈਂਬਰਾਂ ਨਾਲ ਪੰਚਾਇਤ ਪਿੰਡ 'ਚ ਮੀਟਿੰਗ ਬੁਲਾਉਂਦੇ ਹਾਂ ਪੰਚਾਇਤ ਇਕੱਠੀ ਕਰਦੇ ਹਾਂ ਅਤੇ ਕਰਦੇ ਹਾਂ ਤੁਹਾਡੀ ਇਸ ਗੱਲ ਦਾ ਹੱਲ ਓਕੇ ਓਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ